ਭਾਰਤ ਦਾ ਇਤਿਹਾਸ ਹੈ ਕਿ ਇਸ ਦੇ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਜੰਗਾਂ ਲੜੀਆਂ ਗਈਆਂ ਹਨ ਜਿਸ ਵਿੱਚ ਬਹੁਤ ਸਾਰੀਆਂ ਜੰਗਾਂ ਵਿੱਚ ਬਹੁਤ ਸਾਰੇ ਲੋਕ ਸ਼ਹੀਦ ਹੋਏ ਜਿਸ ਦੀ ਸ਼ਹੀਦੀਆਂ ਕਰਕੇ ਅੱਜ ਭਾਰਤ ਇੱਕ ਬਹੁਤ ਵਧੀਆ ਪੱਧਰ 'ਤੇ ਹੈ ਅੱਜ ਤੋਂ ਬਹੁਤ ਟਾਈਮ ਪਹਿਲਾਂ ਬਹੁਤ ਸਾਰੀ ਲੜਾਈਆਂ ਲੜੀਆਂ ਹਨ ਜਿਸ ਵਿੱਚ ਮੇਰੀ ਫੇਵਰੇਟ ਮੇਰਾ ਫੇਵਰੇਟ ਇਤਿਹਾਸਕ ਪਲ ਹੈ ਜੋ ਕਿ ਸ਼ਹੀਦ ਭਗਤ ਸਿੰਘ ਦੁਆਰਾ ਹੈ ਭਗਤ ਸਿੰਘ ਦਾ ਜਨਮ ਅਠਾਈ ਸਤੰਬਰ ਉੱਨੀ ਸੌ ਸੱਤ ਵਿੱਚ ਬੰਗਾ ਪਾਕਿਸਤਾਨ ਵਿੱਚ ਹੋਇਆ ਭਗਤ ਸਿੰਘ ਪਾਕਿਸਤਾਨ ਦੇ ਰਹਿਣ ਵਾਲੇ ਸੀ ਅਤੇ ਇਹਨਾਂ ਨੇ ਬਹੁਤ ਇਤਿਹਾਸਕ ਪਲ ਰਚਿਆ ਹੈ ਇਹਨਾਂ ਨੇ ਆਪਣੇ ਜ ਆਪਣੇ ਜੋ ਦਰਬਾਰ ਸਾਹਿਬ ਹਮਲਾ ਹੋਇਆ ਸੀਗਾ ਉਸ ਵਿੱਚ ਜੋ ਬਹੁਤ ਸਾਰੇ ਮਾਸੂਮ ਮਾਰੇ ਗਏ ਅੰਗਰੇਜ਼ਾਂ ਵੱਲੋਂ ਜੋ ਕਿ ਕਿਸੇ ਨੂੰ ਉਸ ਵਿੱਚ ਕੋਈ ਜਾਤੀ ਕੋਈ ਕੁਛ ਨਹੀਂ ਸੀਗਾ ਅੰਗਰੇਜ਼ਾਂ ਵੱਲੋਂ ਨ ਬਹੁਤ ਸਾਰੇ ਜੋ ਗੁਨਾਹਗਾਰ ਸੀਗੇ ਉਹ ਮਾਰੇ ਗਏ ਤਾਂ ਜਿਸ ਦਾ ਬਦਲਾ ਭਗਤ ਸ਼ਹੀਦ ਭਗਤ ਸਿੰਘ ਨੇ ਲਿਆ ਇਹ ਬਾਹਰ ਗਏ ਜਿਹੜੀ ਕੰਟਰੀ ਦਾ ਉਹ ਅੰਗਰੇਜ਼ ਸੀਗੇ ਜੋਨੀ ਬ੍ਰਿਟਿਸ਼ ਪੁਲਿਸ ਔਫਿਸਰ ਸੀਗਾ ਜਿਸ ਨੇ ਗੋਲੀਆਂ ਚਲਵਾਈਆਂ ਅਤੇ ਸ਼ਹੀਦ ਭਗਤ ਸਿੰਘ ਨੇ ਜਾ ਕੇ ਉਹਨੂੰ ਉਸਦੀ ਹੀ ਕੰਟਰੀ ਵਿੱਚ ਮਾਰਿਆ ਜਿਸ ਦਾ ਬਦਲਾ ਪੂਰਾ ਕੀਤਾ ਅਤੇ ਭਗਤ ਸਿੰਘ ਦਾ ਦਿਹਾਂਤ ਸਤਾਈ ਮਾਰਚ ਉੱਨੀ ਸੌ ਇਕੱਤੀ ਵਿੱਚ

ਅਤੇ ਲਾਹੌਰ ਸੈਂਟਰਲ ਜੇਲ੍ਹ ਲਾਹੌਰ ਪਾਕਿਸਤਾਨ ਵਿੱਚ ਉਨਾਂ ਦੀ ਹੱਤਿਆ ਹੋਈ